ਮੈਂ ਹੁਣ ਤੱਕ ਕਈ ਤਸ ਤਸ ਕਈ ਕਿਸਮਾਂ ਦੀਆਂ ਤਸਵੀਰਾਂ ਖਿੱਚੀਆਂ ਹਨ ਜਿਵੇਂ ਪ੍ਰਕਿਰਤੀ ਪੋ ਪੋਟਰੇਟ ਵਿਆਹ ਸ਼ਾਦੀ ਅਤੇ ਸਟਰੀਟ ਫੋ ਫੋਟਰਿੰਗ ਫੋਟਰਿੰਗ ਬ ਮੇਰੀ ਸਭ ਤੋਂ ਵਧੀਕ ਦਿਲਚਸਪੀ ਪ੍ਰਕਿਰਤੀ ਅਤੇ ਪੋਟਵੱਲ ਹੈ ਜਿਸ ਵਿੱਚ ਮੈਨੂੰ ਕਈ ਵਾਰੀ ਇਹੋ ਜਿਹੇ ਇਹੋ ਜਿਹੇ ਸੀਨ ਦਿਖੇ ਹਨ ਜੋ ਕਿ ਬਹੁਤ ਹੀ ਪ੍ਰਭਾਵਿਤ ਹਨ ਅਤੇ ਅਟਰੈਕਟਿਵ ਲੱਗਦੇ ਹਨ ਜਿਵੇਂ ਕਿ ਇੱਕ ਵਾਰੀ ਮੈਂ ਕਸ਼ਮੀਰ ਕਸ਼ਮੀਰ ਦੀਆਂ ਵਾਦੀਆਂ ਦੀਆਂ ਇਹ ਫੋਟੋਆਂ ਖਿੱਚੀਆਂ ਸੀ ਜਿਸ ਵਿੱਚ ਸੂਰਜ ਦੀਆਂ ਕਿਰਨਾਂ ਅਤੇ ਇਸ ਹਿਸਾਬ ਨਾਲ ਦਰਖਤਾਂ 'ਤੇ ਪੈਂਦੀ ਸਨ ਕਿ ਕਿ ਉਹ ਬਹੁਤ ਹੀ ਸੋਹਣਾ ਮਾਹੌਲ ਲੱਗ ਰਿਹਾ ਸੀ ਅਤੇ ਇੱਕ ਵਾਰੀ ਮੈਂ ਰੋਕ ਗਾਰਡਨ ਗਿਆ ਸੀ ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਮੂਰਤੀਆਂ ਚੂੜੀਆਂ ਦੇ ਨਾਲ ਬਣੀਆਂ ਸੀ ਉਸ ਦੀ ਫੋਟੋ ਲਿੱਤੀ ਅਤੇ ਉਸ ਵਿੱਚ ਮੈਂ ਦੇਖਿਆ ਕਿਵੇਂ ਇੱਕ ਨੋਰਮਲ ਮੂਰਤੀ ਇੱਕ ਆਸਾਨ ਸਧਾਰਨ ਮੂਰਤੀ ਨੂੰ ਇਹਨਾਂ ਨੇ ਟੁੱਟੀਆਂ ਚੂੜੀਆਂ ਦੇ ਨਾਲ ਜੋੜ ਕੇ ਉਸ ਨੂੰ ਹੋਰ ਵੀ ਆਕਰਸ਼ਿਤ ਬਣਾਇਆ ਹੈ ਇੱਕ ਹੋਰ ਇੱਕ ਵਾਰੀ ਮੈਂ ਕਾਲਜ ਦੇ ਕਿਸੇ ਕੋਪੀਟੀਸ਼ਨ ਵਿੱਚ ਗਿਆ ਸੀ ਜਿਸ ਵਿੱਚ ਮੈਂ ਮੇਰੇ ਨਾਲ ਦੇ ਸਾਥੀਆਂ ਦੀਆਂ ਤਸਵੀਰਾਂ ਲੈ ਕੇ ਦੇਖੀ ਤਸਵੀਰਾਂ ਤਸਵੀਰਾਂ ਲਿੱਤੀਆਂ ਸਨ ਜਿਸ ਵਿੱਚ ਉਹ ਇੱਕ ਟੋਪਿਕ 'ਤੇ ਬੋਲ ਰਹੇ ਸਨ ਅਤੇ ਅਤੇ ਬਹੁਤ ਹੀ ਅਤੇ ਸ ਅਤੇ ਉਸ ਟੋਪਿਕ ਬਾਰੇ ਸਮਝਾਉਂਦੇ ਸਨ ਅਤੇ ਹੋਰ ਵੀ ਕਈ ਮੈਂ ਤਸਵੀਰਾਂ ਲਿੱਤੀਆਂ ਹੈ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਮੇਰਾ ਇਹ ਟੋਪਿਕ ਚੰਗਾ ਲੱਗੇਗਾ ਧੰਨਵਾਦ